ਮੇਰੇ ਕੋਲਜ ਕੁਛ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਸੀ ਮੈਂ ਸੋਚ ਰਹੀ ਸੀ ਕਿ ਚਲੋ ਮਾੜੇ ਮੋਟੇ ਕੱਪੜੇ ਅਤੇ ਕੁਝ ਦੇਖਿਆ ਜਾਵੇ ਬਟ ਮੈਂ ਦੇਖਿਆ ਕਿ ਜੋ ਕੁਛ ਵੀ ਮਿਲਦਾ ਹੈ ਉਹ ਸਭ ਬਹੁਤ ਜ਼ਿਆਦਾ ਹੀ ਪੈਸਿਆਂ 'ਚ ਮਿਲਦਾ ਹੈ ਅਤੇ ਬਜਟ ਤੋਂ ਬਾਹਰ ਹੀ ਹੁੰਦਾ ਹੈ ਇਸ ਕਰਕੇ ਮੈਂ ਸੋਚਿਆ ਚਲੋ ਥੋੜ੍ਹਾ ਬਹੁਤ ਔਨਲਾਈਨ ਜਾਂ ਫੇਰ ਔਫਲਾਈਨ ਰਿਸਰਚ ਕੀਤੀ ਜਾਵੇ ਜਦ ਮੈਂ ਦੇਖਿਆ ਤਦ ਮੈਨੂੰ ਪਤਾ ਲੱਗਿਆ ਕਿ ਦੀਵਾਲੀ ਔਫਰ ਵਿੱਚ ਮੈਨੂੰ ਪੰਜਾਹ ਪਰਸੈਂਟ ਔਫ਼ ਚਲਦਾ ਹੈ ਅਤੇ ਨਾਲ ਹੀ ਨਾਲ ਉਹਦੇ ਨਾਲ ਬੈਲਟ ਵਗੈਰਾ ਵੀ ਫ੍ਰੀ ਦੇ ਰਹੇ ਹਨ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਅਤੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਸਮਝਾਇਆ ਵੀ ਜੋ ਚੀਜ਼ ਸਸਤੀ ਮਿਲਦੀ ਹੈ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਹੀ ਵਧੀਆ ਹੋਵੇ ਤਾਂ ਵੀ ਮੈਂ ਜ਼ਿੱਦ ਕਰਕੇ ਉਹਨਾਂ ਨੂੰ ਕਹਿ ਕੇ ਆਪਣੀ ਚੀਜ਼ ਘਰ ਤੋਂ ਮੰਗਾ ਲਈ ਉਹ ਵੀ ਮੈਂ ਆਪਣੇ ਇੱਕ ਵਾਰ 'ਚ ਹੀ ਹਜ਼ਾਰ ਰੁਪਏ ਦੇ ਆਸ ਪਾਸ ਲਗਾ ਦਿੱਤੇ ਮੈਂ ਸੋਚਿਆ ਇਕੱਠੀ ਚੀਜ਼ਾਂ ਆ ਜਾਵੇਗੀ ਅਤੇ ਆਹ ਲਾਭ ਇਕੱਠਾ ਹੀ ਉਠਾਇਆ ਜਾਵੇ ਕੀ ਪਤਾ ਬਾਅਦ 'ਚ ਔਫਰ ਬੰਦ ਹੋ ਜਾਵੇ ਲੇਕਿਨ ਜਦ ਮੈਨੂੰ ਰੀਸਿਵ ਹੋਇਆ ਮੈਂ ਤਾਂ ਦੇਖ ਕੇ ਬਿਲਕੁਲ ਹੈਰਾਨ ਹੋ ਗਈ ਮੈਨੂੰ ਇੱਕ ਟੈਂਟ ਦੇ ਕੱਪੜੇ ਵਰਗੀ ਫਫ ਚੀਜ਼ ਮਿਲੀ ਫੋਟੋ 'ਚ ਤਾਂ ਦਿਖਾਇਆ ਸੀ ਬਹੁਤ ਜ਼ਿਆਦਾ ਸੋਹਣੀ ਗਾਊਨ ਹੈ ਬਟ ਉਹ ਜਮ੍ਹਾ ਹੀ ਟੈਂਟ ਦੇ ਕੱਪੜੇ ਵਰਗੀ ਨਿਕਲੀ ਅਤੇ ਮੈਂ ਆਹ ਵੀ ਸੋਚਿਆ ਸੀ ਕਿ ਰਾਤ ਨੂੰ ਮੇਰੀ ਕਜ਼ਨ ਦਾ ਵਿਆਹ ਹੈ ਮੈਂ ਉੱਧਰ ਉਸ ਗਾਊਨ ਨੂੰ ਪਾ ਕੇ ਜਾਵਾਂਗੀ ਲੇਕਿਨ ਪਾਉਣ ਲਾਇਕ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਇੰਨੀ ਬੇਕਾਰ ਨਿਕਲੀ ਕਿ ਉਸਨੂੰ ਅਸੀਂ ਘਰ 'ਚ ਵੀ ਪਾ ਨਹੀਂ ਸਕਦੇ ਮੇਰਾ ਦਿਲ ਬਹੁਤ ਜ਼ਿਆਦਾ ਟੁੱਟ ਗਿਆ ਅਤੇ ਫਿਰ ਮੇਰੇ ਮਾਪੇ ਵੀ ਮੈਨੂੰ ਕਹਿਣ ਲੱਗ ਪਏ ਕਿ ਤੂੰ ਆਪਣੇ ਸਾਰੇ ਪੈਸੇ ਬਰਬਾਦ ਕਰ ਦਿੱਤੇ ਅਸੀਂ ਤਾਂ ਤੈਨੂੰ ਕਿਹਾ ਹੀ ਸੀ ਕਿ ਜਿਹੜੀ ਚੀਜ਼ ਸਸਤੀ ਮਿਲਦੀ ਹੈ ਉਹ ਜਰੂਰੀ ਨਹੀਂ ਹਮੇਸ਼ਾ ਹੀ ਚੰਗੀ ਹੋਵੇ ਫੋਟੋ 'ਚ ਤਾਂ ਕੁਛ ਦਿਖਾਇਆ ਸੀ ਲੇਕਿਨ ਆਇਆ ਕੁਛ ਈਵਨ ਮੈਂ ਆਪਣੇ ਕਜ਼ਨ ਦੇ ਵਿਆਹ 'ਤੇ ਵੀ ਨਹੀਂ ਜਾ ਪਾਈ ਕਿਉਂਕਿ ਮੇਰੇ ਕੋਲ ਪਾਉਣ ਲਈ ਕੱਪੜੇ ਨਹੀਂ ਸੀ ਸਿਰਫ ਔਰ ਸਿਰਫ ਮੇਰੀ ਗਲਤ ਚੋਇਸ ਕਰਕੇ ਤਾਂ ਕਰਕੇ ਮੈਂ ਇਸ ਪ੍ਰੋਡਕਟ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਉੱਪਰ ਤੋਂ ਇਸ ਨੇ ਮੇਰੇ ਕਜ਼ਨ ਦੇ ਵਿਆਹ ਦਾ ਮਜ਼ਾ ਵੀ ਖਰਾਬ ਕਰ ਦਿੱਤਾ